ਹੈਲੋ ਹਾਂਜੀ ਤੁਸੀਂ ਟੂਰਿਸਟ ਗਾਈਡ ਹਾਂਜੀ ਤੁਸੀਂ ਟੂਰਿਸਟ ਗਾਈਡ ਬੋਲ ਰਹੇ ਹੋ ਜੀ ਹਾਂਜੀ ਅਸੀਂ ਨਾ ਜੀ ਚੰਡੀਗੜ੍ਹ ਤੋਂ ਆਏ ਆਂਗੇ ਬਰਨਾਲੇ ਹਾਂ ਹਾਂਜੀ ਅਸੀਂ ਨਾ ਇੱਕ ਡਾਟਾ ਤਿਆਰ ਕਰ ਰਹੇ ਸੀਗੇ ਫੇਮਸ ਪੀਪਲਜ ਦਾ ਅਤੇ ਉਹ ਫੇਮਸ ਪਰਸਨੈਲਿਟੀ ਅਸੀਂ ਹਰੇਕ ਜਿਲ੍ਹੇ ਦੇ ਵਿੱਚੋਂ ਦੇਖ ਰਹੇ ਹਾਂਗੇ ਹਰੇਕ ਜਿਲ੍ਹੇ ਦੇ ਵਿੱਚੋਂ ਅਸੀਂ ਡਾਟਾ ਇਕੱਠਾ ਕੀਤਾ ਵਾ ਫੇਮਸ ਪਰਸਨੈਲਿਟੀਜ਼ ਦਾ ਚਾਹੇ ਉਹ ਜਿਵੇਂ ਕਿ ਕੋਈ ਖਿਡਾਰੀ ਹੋਵੇ ਜਾਂ ਕੋਈ ਲੇਖਕ ਹੋਵੇ ਜਾਂ ਕੋਈ ਸਿੰਗਰ ਹੋਵੇ ਜਾਂ ਫਿਰ ਕੋਈ ਪੋਲੀਟੀਸ਼ੀਅਨ ਹੋਵੇ ਅਤੇ ਅਸੀਂ ਬਰਨਾਲੇ ਦਾ ਵੀ ਡਾਟਾ ਇਕੱਠਾ ਕਰਨਾ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਬਰਨਾਲੇ ਸ਼ਹਿਰ ਦੇ ਵਿੱਚ ਕਿਹੜੇ ਫੇਮਸ ਫੇਮਸ ਪੀਪਲ ਨੇਗੇ ਠੀਕ ਹੈ ਜੀ ਹਾਂਜੀ ਹਾਂਜੀ ਮੈਂ ਪੀਪਲਸ ਬਾਰੇ ਕਰ ਰਹੀ ਹਾਂ ਜੀ ਫੇਮਸ ਪੀਪਲ ਕਿਹੜੇ ਕਿਹੜੇ ਨੇ ਜੀ ਹਾਂਜੀ ਅੱਛਾ ਜੀ ਠੀਕ ਹੈ ਹਾਂਜੀ ਮੈਨੂੰ ਲੱਗਦਾ ਇਹ ਸ਼ਾਇਦ ਨਾ ਮ ਪਹਿਲਾਂ ਇਹ ਉਹਦੇ 'ਚ ਸੀ ਨਾ ਅਕਾਲੀ ਦਲ ਦੇ ਵਿੱਚ ਸੀ ਨਾ ਹਾਂਜੀ ਅਕਾਲੀ ਦਲ ਵੱਲੋਂ ਸੀ ਐਮ ਰਹੇ ਨੇ ਨਾ ਆਪਣੇ ਪੰਜਾਬ ਦੇ ਅੱਛਾ ਠੀਕ ਹੈ ਉਹ ਤੁਹਾਡੀ ਸਿਟੀ ਦੇ ਨੇਗੇ ਬਰਨਾਲੇ ਦੇ ਸੀ ਉਹ ਅੱਛਾ ਜੀ ਠੀਕ ਹੈ ਜੀ ਅੱਛਾ ਠੀਕ ਹੈ ਜੀ ਉਹ ਬੀ ਜੇ ਪੀ ਦੇ ਲੀਡਰ ਨੇ ਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਕਿਹੜੀ ਪਾਰਟੀ ਨਾਲ ਰਿਲੇਟਡ ਨੇ ਜੀ ਉਹ ਠੀਕ ਠੀਕ ਹੈ ਜੀ ਅੱਛਾ ਜੀ ਠੀਕ ਹੈ ਠੀਕ ਹੈ ਜੀ ਅੱਛਾ ਠੀਕ ਹੈ ਜੀ ਅੱਛਾ ਠੀਕ ਹੈ ਜੀ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਉਹ ਵੀ ਬਰਨਾਲੇ ਤੋਂ ਹੀ ਨੇ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਜੇ ਮੈਨੂੰ ਇਹਨਾਂ ਦੀ ਹੋਰ ਮਤਲਬ ਇਹਨਾਂ ਦੀ ਬਾਈਓਗਰਾਫੀ ਦੀ ਲੋੜ ਪਈ ਕਿ ਮੈਨੂੰ ਮੈਂ ਤੁਹਾਨੂੰ ਫਿਰ ਦੁਬਾਰਾ ਕਾਲ ਕਰਾਂਗੀ ਠੀਕ ਹੈ ਜੀ ਜੇ ਮਤਲਬ ਮੈਨੂੰ ਲੋੜ ਪਈ ਨਾ ਤੁਸੀਂ ਮੈਨੂੰ ਦੱਸ ਸਕਦੇ ਇਹਨਾਂ ਬਾਰੇ ਹੋਰ ਡਿਟੇਲ ਦੇ ਵਿੱਚ ਹਾਂਜੀ ਹਾਂਜੀ ਮੈਂ ਨਾ ਆਪਣਾ ਡਾਟਾ ਤਿਆਰ ਕਰ ਰਹੀ ਹੈਗੀ ਅਤੇ ਹੁਣ ਮੈਂ ਨਾ ਬਰਨਾਲਾ ਸਿਟੀ 'ਤੇ ਆਈ ਹੈਗੀ ਮੈਨੂੰ ਪਹਿਲਾਂ ਕਾਫ਼ੀ ਸਿਟੀਜ਼ ਦੇ ਵਿੱਚ ਕੀਤਾ ਗਾ ਠੀਕ ਹੈ ਜੀ ਅੱਛਾ ਜੀ ਠੀਕ ਹੈ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਤੁਹਾਨੂੰ ਦੱਸ ਦੇਵਾਂਗੇ ਅਤੇ ਬਾਕੀ ਜੇ ਹੋਰ ਉਹਨਾਂ ਦੀ ਲੋੜ ਪਈ ਹੈ ਨਾ ਤਾਂ ਡਿਟੇਲ ਦੀ ਮੈਂ ਤੁਹਾਨੂੰ ਦੁਬਾਰਾ ਕਾਲ ਕਰੂੰ ਜੀ ਠੀਕ ਹੈ ਜੀ ਹਾਂਜੀ ਓਕੇ ਜੀ